ਹੈਲੋ ਅੱਜ ਦਾ ਸਾਡਾ ਟੋਪਿਕ ਹੈਗਾ ਕਿ ਔਰਤਾਂ ਨੂੰ ਰੋਜ਼ਾਨਾ ਕਿਹੜੇ ਕਿਹੜੇ ਕੰਮਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਔਰਤਾਂ ਜਿਹੜੀਆਂ ਦੇਖੋ ਜੀ ਘਰ ਦਾ ਕੰਮ ਵੀ ਕਰ ਲੈਂਦੀਆਂ ਨੇ ਅਤੇ ਸਾਨੂੰ ਮਤਲਬ ਔਰਤਾਂ ਬਾਹਰ ਦਾ ਕੰਮ ਵੀ ਕਰ ਲੈਂਦੀਆਂ ਨੇ ਔਰਤਾਂ ਨੂੰ ਘਰ ਦਾ ਕੰਮ ਸਵੇਰੇ ਉੱਠ ਕੇ ਜਲਦੀ ਕਰਕੇ ਫਿਰ ਅ ਅਸੀਂ ਬਾਹਰ ਦਾ ਕੰਮ ਵੀ ਕਰਨ ਜਾਂਦੀਆਂ ਨੇ ਬਾਹਰ ਦਾ ਬਾਹਰ ਦਾ ਮਤਲਬ ਆਪਣੀ ਡਿਊਟੀ ਵਗੈਰਾ ਕੰਪਲੀਟ ਕਰਕੇ ਫਿਰ ਉਹ ਘਰ ਆ ਕੇ ਫਿਰ ਦੁਬਾਰਾ ਕਰਦੀਆਂ ਨੇ ਅੱਜ ਕੱਲ੍ਹ ਦੀਆਂ ਔਰਤਾਂ ਜਿਹੜੀਆਂ ਮਰਦਾਂ ਦੇ ਬਿਲਕੁਲ ਬਰਾਬਰ ਨੇ ਕਿ ਉਹ ਕੋਈ ਕੰਮ ਨਹੀਂ ਦੇਖਦੀਆਂ ਛੋਟਾ ਵੱਡਾ ਜੋ ਵੀ ਇਹ ਸਭ ਅੱਜ ਕੱਲ੍ਹ ਕਰ ਲੈਂਦੀਆਂ ਨੇ ਮਤਲਬ ਜਿਹੜੀਆਂ ਔਰਤਾਂ ਨੇ ਅਜ ਅੱਜ ਅੱਜ ਕੱਲ੍ਹ ਦੇ ਤਰੀਕ ਅੱਜ ਕੱਲ੍ਹ ਦੇ ਟਾਈਮ ਵਿੱਚ ਜੋ ਕਿ ਔਰਤਾਂ ਮਰਦਾਂ ਤੋਂ ਅੱਗੇ ਨੇ ਹਰ ਇੱਕ ਕੰਮ ਕਾਰਜ ਪੂਰਾ ਕਰਦੀਆਂ ਨੇ ਆਪਣਾ ਕੋਈ ਕੰਮ ਛੋਟਾ ਮੋਟਾ ਵੇਖ ਕੇ ਨਹੀਂ ਕਰਦੀਆਂ ਹੈਗੀਆਂ ਇਸ ਕਰਕੇ ਔਰਤਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਸੁਰਕਸ਼ਿਤ ਹੈਗੀ ਉਹ ਆਪਣੇ ਹੱਥ ਵਿੱਚ ਹੈਗੀ ਏ ਅਤੇ ਕੰਮ ਵੀ ਜੋ ਬਿਲਕੁਲ ਵੀ ਪਿੱਛੇ ਨਹੀਂ ਹੈਗੀਆਂ ਉਹ ਹਮੇਸ਼ਾਂ ਹਰ ਕੰਮ ਵਿੱਚ ਅੱਗੇ ਹੀ ਰਹਿੰਦੀਆਂ ਨੇ ਅਤੇ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਦੇ ਬਰਾਬਰ ਬਿਲਕੁਲ ਬਰਾਬਰ ਨੇ ਕਿ ਕੋਈ ਕੰਮ ਵੀ ਕਰਨਾ ਹੋਵੇ ਕੋਈ ਛੋਟਾ ਮੋਟਾ ਕੰਮ ਨਹੀਂ ਦੇਖਦੀਆਂ ਉਹ ਹਰ ਇੱਕ ਕੰਮ ਨੂੰ ਕਾਰਜ ਪੂਰਾ ਕਰਕੇ ਹੀ ਸਾਹ ਲੈਂਦੀਆਂ ਹਨ